ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਡੇ ਕੰਪਨੀ ਤੋਂ ਮੋਬਾਈਲ ਖਰੀਦਿਆ ਸੀ ਅਤੇ ਮੈਂ ਉਸ ਆਰਡਰ ਨੂੰ ਦੋ ਦਿਨ ਪਹਿਲਾਂ ਹੀ ਕੈਂਸਲ ਕੀਤਾ ਸੀ ਅਤੇ ਉਹਦਾ ਰਿਫੰਡ ਅਤੇ ਕਦੋਂ ਮੇਰੇ ਫ਼ੋਨ 'ਤੇ ਆ ਜਾਵੇਗਾ ਤੁਸੀਂ ਦੱਸ ਸਕਦੇ ਹੋ ਹਾਂਜੀ